ਅੱਜ ਮੈਂ ਬਹੁਤ ਖੁਸ਼ ਹਾਂ ਮੈਂ ਸੈਮਸੰਗ ਦਾ ਐਂਡਰਾਇਡ ਫੋਨ ਨਵਾਂ ਲਿਆ ਹੈ ਜਿਸ ਦੇ ਵਿੱਚ ਬਹੁਤ ਹੀ ਵਧੀਆ ਫੰਕਸ਼ਨ ਹਨ ਇੱਕ ਚਾਰਜਿੰਗ ਬਹੁਤ ਵਧੀਆ ਮੇਰਾ ਪੁਰਾਣਾ ਫੋਨ ਬਹੁਤ ਦੇਰ ਲਾਉਂਦਾ ਸੀ ਚਾਰਜ ਹੋਣ ਇਹ ਫਟਾਫਟ ਚਾਰਜ ਹੋ ਜਾਂਦਾ ਹੈ ਅਤੇ ਇਹਦੇ ਨਾਲ ਮੈਨੂੰ ਕਿਤੇ ਵੀ ਜਾਣਾ ਹੋਵੇ ਲੋਕੇਸ਼ਨ ਆਪੇ ਲੈ ਜਾਂਦਾ ਅਤੇ ਇਸ ਫੋਨ ਦਾ ਕੈਮਰਾ ਬਹੁਤ ਵਧੀਆ ਹੈ ਇਹਦੇ ਨਾਲ ਫੋਟੋ ਕਲਿੱਕ ਕਰਕੇ ਆਪਾਂ ਆਪਣੀ ਫੈਮਲੀ ਦੀ ਕੋਈ ਯਾਦ ਇਹਦੇ ਵਿੱਚ ਸੇਵ ਕਰ ਸਕਦੇ ਹਾਂ ਮੈਮਰੀ ਬਹੁਤ ਵਧੀਆ ਹੈ ਇਹਦੀ ਅਤੇ ਹੋਰ ਬੱਚਿਆਂ ਨੂੰ ਕੋਈ ਦਿੱਕਤ ਹੈ ਅਤੇ ਉਹ ਇਹਦੇ ਰਾਹੀਂ ਆਪਣਾ ਕੁਸ਼ਚਨ ਵਿੱਚ ਲਿਖਣ ਗੂਗਲ 'ਚ ਅਤੇ ਉਹਦਾ ਅਨਸਰ ਜਦੇ ਹੀ ਮਿਲ ਜਾਂਦਾ ਹੈ ਅਤੇ ਇਸ ਦੇ ਨਾਲ ਮੈਂ ਆਪਣਾ ਜੇ ਸਵਿਗੀ ਦਾ ਕੰਮ ਸ਼ੁਰੂ ਕਰਿਆ ਹੈ ਸਵਿਗੀ ਦੀ ਇਹਦੇ ਨਾਲ ਮੈਨੂੰ ਇਨਕਮ ਹੋ ਰਹੀ ਹੈ ਸਵਿਗੀ ਦੇ ਕਸਟਮਰ ਦੀ ਲੋਕੇਸ਼ਨ 'ਤੇ ਜਾਣ ਵਾਸਤੇ ਲੋਕੇਸ਼ਨ 'ਤੇ ਆਪੇ ਲੇੈ ਜਾਂਦਾ ਹੈ ਅਤੇ ਹੋਰ ਵੀ ਇਹਦੇ ਨਾਲ ਬਹੁਤ ਵਧੀਆ ਨਿਊਜ਼ ਵਗੈਰਾ ਕੋਈ ਚਾਹੀਦੀ ਹੈ ਉਹ ਨਿਊਜ਼ ਵੀ ਇਹਦੇ 'ਚ ਆ ਜਾਂਦੀ ਹੈ ਜੇ ਆਪਾਂ ਕੋਈ ਵੀ ਗੱਲ ਕਰੀਏ ਕਿਸੇ ਜਗ੍ਹਾ ਜਾਣਾ ਹੈ ਆਪਾਂ ਉਸ ਏਰੀਏ ਦੀ ਨੋਲੇਜ ਇਹਦੇ 'ਚੋਂ ਲੈ ਸਕਦੇ ਹਾਂ ਗੇਮਸ ਖੇਡਣ ਨੂੰ ਹੈ ਐਪ ਸਾਰੇ ਹੀ ਹੈਗੇ ਇਹਦੇ ਫੋਨ 'ਚ ਕੋਈ ਵੀ ਤੁਸੀਂ ਚੀਜ਼ ਆਪਣੀ ਸੋਚ ਤੋਂ ਬਾਹਰ ਹੈ ਉਹ ਵੀ ਤੁਸੀਂ ਇਹਦੇ ਗੂਗਲ 'ਚ ਲਿਖੋ ਉਹਦਾ ਤੁਹਾਨੂੰ ਜਵਾਬ ਮਿਲੇਗਾ ਕੰਪਨੀ ਵੱਲੋਂ ਕਵਰ ਵੀ ਨਾਲ ਫਰੀ ਦਿੱਤਾ ਗਿਆ ਹੈ